ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਮੈਂ ਤੁਹਾਨੂੰ ਫ਼ੋਨ ਕੀਤਾ ਸੀ ਮੈਂ ਕਿਹਾ ਬੱਚਿਆਂ ਦਾ ਨਾ ਐਡਮੀਸ਼ਨ ਕਰਵਾਉਣਾ ਸੀ ਅਤੇ ਤੁਸੀਂ ਤਾਂ ਰਹਿਣ ਵਾਲੇ ਇੱਥੋਂ ਦੇ ਹੈਗੇ ਹੀ ਹੋ ਹੈ ਨਾ ਅਤੇ ਮੈਨੂੰ ਕੋਈ ਚਾਨਣਾ ਪਾਓ ਕਿ ਕਿਹੜੇ ਵਧੀਆ ਸਕੂਲ ਹੈਗੇ ਕਿ ਬੱਚਿਆਂ ਦਾ ਆਪਾਂ ਐਡਮੀਸ਼ਨ ਕਰਵਾ ਸਕਦੇ ਤੁਹਾਡੇ ਤਾਂ ਔਲਰੇਡੀ ਬੱਚੇ ਨਾ ਪੜ੍ਹਦੇ ਹੀ ਹੈ ਅਸੀਂ ਨਵੇਂ ਨਵੇਂ ਹਨਾ ਇੱਧਰ ਆਏ ਹੈਗੇ ਹਾਂਜੀ ਜੀ ਜੀ

ਜੀ ਜੀ ਜੀ ਜੀ ਇਹ ਕਿੱਥੇ ਹੈ ਜੀ

ਅੱਛਾ

ਅੱਛਾ

ਜੀ ਜੀ ਜੀ ਜੀ ਸਰ ਇਹ ਤੁਹਾਡੇ ਸਰ ਸਰ ਸੀ ਬੀ ਐੱਸ ਸੀ ਹੈ ਸਰ ਇਹ ਅੱਛ ਅੱਛਾ ਤੁਹਾਡੇ ਬੱਚੇ ਅੱਛਾ ਫੇਰ ਇਹ ਕਿੱਥੇ ਹੈ ਡੇ ਬੋਰਡਿੰਗ ਹੈ ਜਾਂ ਅੱਛਾ ਸਟਾਫ਼ ਕਿੱਦਾਂ ਦਾ ਹੈ ਉਥੇ ਸਟਾਫ਼ ਵਧੀਆ ਕੁਐਲੀਫਾਈਡ ਹੈ ਅੱਛਾ ਅਤੇ ਸਰ ਫਸਿਲਟੀਆਂ ਮਤਲਬ ਜਿਦਾਂ ਬੱਚੇ ਆਪਾਂ ਦੋ ਹੈ ਨਾ ਪਾਉਣੇ ਹੈਗੇ ਅਤੇ ਇੱਕ ਨੂੰ ਫੀਸ ਮਾਫ਼ ਹੈਗੀ ਕਿ ਨਹੀਂ ਹੈਗੀ ਅੱਛਾ ਅਤੇ ਸਰ ਫੈਸਿਲਿਟੀ ਕੀ ਬਸ ਬੁਸ ਤਾਂ ਆ ਹੀ ਜਾਂਦੀ ਹੋਣੀ ਬਸ ਵਗੈਰਾ ਹਨਾ ਅੱਛਾ

ਨਹੀਂ ਜੇ ਕੋਈ ਜੇ ਕੋਈ ਜੇ ਪੇਰੈਂਟਸ ਤੋਂ ਬਿਨਾਂ ਕੋਈ ਬੱਚਾ ਲੈਣ ਜਾਵੇ ਕੀ ਉਹ ਬੱਚਾ ਦੇ ਦਿੰਦੇ ਹੈ ਕਿ ਨਹੀਂ ਦਿੰਦੇ ਹੈਗੇ ਮੈਂ ਕਿਹਾ ਜੇ ਪੇਰੈਂਟਸ ਤੋਂ ਬਿਨਾਂ ਕੋਈ ਜਾਵੇ ਉਥੇ ਨਾ ਬੱਚਾ ਲੈਣ ਤਾਂ ਕੀ ਬੱਚਾ ਦੇ ਦਿੰਦੇ ਹੈ ਕਿ ਨਹੀਂ ਦਿੰਦੇ ਕਿ ਜਾਂ ਪੂਰੀ ਪੈਰਵਾਈ ਕਰਦੇ ਆ ਸਕੂਲ ਵਾਲੇ ਅੱਛਾ ਚਲੋ ਸਰ ਬਹੁਤ ਵਧੀਆ ਲੱਗਿਆ ਚਲੋ ਮੈਂ ਵੀ ਸੋਚਦੀ ਆਪਾਂ ਕਿ ਚਲੋ ਇਹੀ ਸਕੂਲ 'ਚ ਪਾ ਦਿੰਦੇ ਹਾਂ ਅਸੀਂ ਬੱਚੇ ਨੂੰ ਤੁਹਾਡੇ ਵਾਲੇ 'ਚ ਹੀ ਨਹੀਂ ਹਾਂ ਚਲੋ ਚਲੋ ਠੀਕ ਐ ਸਰ ਚਲੋ ਥੈਂਕ ਯੂ ਸਰ ਇਨਫੋਰਮੇਸ਼ਨ ਦੇਣ ਵਾਸਤੇ ਮੈਨੂੰ ਨਾ ਮੈਨੂੰ ਦਿੱਤੀ ਇਨਫੋਰਮੇਸ਼ਨ ਬਹੁਤ ਵਧੀਆ ਤੁਸੀਂ ਚਲੋ ਠੀਕ ਹੈ ਸਰ ਥੈਂਕ ਯੂ ਵੀਰ ਥੈਂਕ ਯੂ ਓਕੇ ਓਕੇ